ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਪੰਦਰਾਂ ਫਰਵਰੀ ਉੱਨੀ ਸੌ ਇਕਹਾਠ ਇੱਕ ਨਵੰਬਰ ਦੋ ਹਜ਼ਾਰ ਸਤਾਈ ਜੂਨ ਵੀਹ ਸੌ ਅਠਾਰਾਂ